ਬਾਗਵਾਨੀ ਕਰਦੇ ਸਮੇਂ ਕਈ ਚੁਣੌਤੀਆਂ ਤਾਂ ਆਉਂਦੀਆਂ ਆ ਜਿਵੇਂ ਕਿ ਜ਼ਿਆਦਾ ਇਹਨਾਂ ਦੇ ਵੱਡੀ ਚੁਣੌਤੀ ਇਹ ਹੁੰਦੀ ਆ ਕਿ ਕਿਸੇ ਕਿਸਮ ਦਾ ਕੀਟ ਲੱਗ ਜਾਣੀ ਕੀੜੇ ਲੱਗ ਜਾਣੇ ਇਹ ਬੜਾ ਵੱਡੀ ਚੁਣੌਤੀ ਦਾ ਕਾਰਨ ਹੈ ਜਿਵੇਂ ਕਿ ਸਾਡੇ ਦਰਖਤ ਤੇਲਾ ਨਾਂ ਦਾ ਕੀਟ ਹੁੰਦਾ ਤੇਲਾ ਜਿਹੜਾ ਲੱਗ ਜਾਂਦਾ ਜਿਹੜਾ ਕੀਟ ਪੌਦਿਆਂ ਨੂੰ ਅਤੇ ਉਹ ਜ਼ਿਆਦਾ ਨੁਕਸਾਨ ਕਰਦਾ ਅਤੇ ਉਹਨੂੰ ਥੋੜ੍ਹਾ ਜਿਹਾ ਮਤਲਬ ਕਿ ਇਹ ਖ਼ਤਮ ਕਰਨਾ ਵੀ ਥੋੜ੍ਹਾ ਜਿਹਾ ਔਖਾ ਹੁੰਦਾ ਬਾਕੀ ਜੇ ਕੀੜੀਆਂ ਦੀ ਗੱਲ ਕਰੀਏ ਕੀੜੀਆਂ ਵੀ ਆਹ ਥੱਲੇ ਆ ਜਿਹੜੀਆਂ ਖੁੱਡਾਂ ਕੱਢ ਦਿੰਦੀਆਂ ਮਿੱਟੀ ਦੇ ਵਿੱਚ ਵਿੱਚ ਆਪਣੀ ਉਹ ਆਂਡੇ ਦੇ ਦਿੰਦੀਆਂ ਨੇ ਭੌਣ ਬਣ ਜਾਂਦਾ ਹੈ ਅਤੇ ਇਹ ਵੀ ਸਮੱਸਿਆ ਆਉਂਦੀ ਹੈ ਅਤੇ ਇਹਨੂੰ ਦੂਰ ਕਰਨ ਲਈ ਅਤੇ ਅਸੀਂ ਇੱਕ ਛੋਟਾ ਜਿਹਾ ਫਾਰਮੂਲਾ ਵਰਤਦੇ ਨੇ ਇੱਧਰ ਆਪਾਂ ਕਿ ਮਿੱਟੀ ਦੇ ਵਿੱਚ ਹਲਦੀ ਮਿਲਾ ਕੇ ਅਤੇ ਉਹ ਪਾ ਦਿੰਦੇ ਹਾਂ ਬੂਟਿਆਂ ਨੂੰ ਹਲਦੀ ਮਿੱਟੀ ਦੇ ਵਿੱਚ ਮਿਲਾਉਣ ਦੇ ਨਾਲ ਫਿਰ ਜਿਹੜੀਆਂ ਕੀੜੀਆਂ ਉ ਉਸ ਜਗ੍ਹਾ ਨੂੰ ਛੱਡ ਜਾਂਦੀਆਂ ਯਾਨੀ ਕਿ ਇਹ ਸਮੱਸਿਆ ਖ਼ਤਮ ਹੋ ਜਾਂਦੀ ਹੈ